ਹੈਲੋ ਜੀ ਕੱਲ੍ਹ ਤੁਹਾਡੇ ਜਨਮਦਿਨ ਦੇ ਸੰਬੰਧੀ ਮੈਂ ਇੱਕ ਯੋਜਨਾ ਬਣਾਈ ਹੈ ਇਸ ਯੋਜਨਾ ਦੇ ਤਹਿਤ ਆਪਾਂ ਤੁਹਾਡਾ ਜਨਮਦਿਨ ਬੜੇ ਵਧੀਆ ਢੰਗ ਨਾਲ ਮਨਾਵਾਂਗੇ ਕੇਕ ਕੱਟਾਂਗੇ ਗੁਲਾਬ ਜਾਮਨ ਵੀ ਖਾਵਾਂਗੇ ਰਸਗੁੱਲੇ ਵੀ ਖਾਵਾਂਗੇ ਅਤੇ ਬਹੁਤ ਸਾਰੀਆਂ ਮਠਿਆਈਆਂ ਵੀ ਵੰਡਾਂਗੇ ਅਤੇ ਤੁਹਾਨੂੰ ਪਤਾ ਹੈ ਕਿ ਇਸ ਦੇ ਨਾਲ ਨਾਲ ਅਸੀਂ ਇੱਕ ਫਿਲਮ ਦੀ ਸਕਰੀਨਿੰਗ ਵੀ ਦੇਖਾਂਗੇ ਮੈਂ ਇਸਦੀ ਬੁਕਿੰਗ ਕਰ ਲਈ ਹੈ ਆਪਾਂ ਮਿਸਇਜ ਫਿਲਮ ਦੇਖਾਂਗੇ ਇਸ ਫਿਲਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਟੋਪਿਕ ਨੂੰ ਛੇੜਿਆ ਗਿਆ ਹੈ ਕਿ ਇੱਕ ਭੋਲੀ ਭਾਲੀ ਲੜਕੀ ਜਦੋਂ ਉਸਦਾ ਵਿਆਹ ਹੋ ਜਾਂਦਾ ਹੈ ਤਾਂ ਸਾਰੀਆਂ ਜ਼ਿੰਮੇਵਾਰੀਆਂ ਕਿਵੇਂ ਉਸਦੇ ਸਿਰ 'ਤੇ ਆ ਜਾਂਦੀਆਂ ਹਨ ਅਤੇ ਕਿਵੇਂ ਉਹ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਨਿਭਾਉਂਦੀ ਅੱਕ ਜਾਂਦੀ ਹੈ ਉਸਨੇ ਸਵੇਰੇ ਉੱਠ ਕੇ ਸਾਰਿਆਂ ਲਈ ਨਾਸ਼ਤਾ ਬਣਾਉਣਾ ਹੁੰਦਾ ਹੈ ਘਰ ਦੇ ਵਿੱਚ ਇੱਕ ਵੀ ਕੰਮ ਵਾਲੀ ਨਹੀਂ ਲੱਗੀ ਹੋਈ ਹੈ ਸਾਰਾ ਕੰਮ ਉਸਨੂੰ ਆਪਣੇ ਹੀ ਹੱਥਾਂ ਨਾਲ ਕਰਨਾ ਪੈਂਦਾ ਹੈ ਕੋਈ ਵੀ ਸਹੂਲਤ ਘਰ ਵਿੱਚ ਨਹੀਂ ਹੈ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਣੀਆਂ ਮਿੱਠਾ ਬਣਾਉਣਾ ਅਤੇ ਉਹ ਵੀ ਟਰਡੀਸ਼ਨਲ ਢੰਗਾਂ ਨਾਲ ਹੀ ਬਣਾਉਣਾ ਪੈਂਦਾ ਹੈ ਇਸ ਤੋਂ ਬਿਨਾ ਪਰਿਵਾਰ ਦੇ ਸਾਰੇ ਲੋਕ ਰੋਟੀ ਹੀ ਨਹੀਂ ਖਾਂਦੇ ਅਤੇ ਉਹਨਾਂ ਵੱਲੋਂ ਨੂੰਹ ਨੂੰ ਕੁਝ ਬੁਰਾ ਭਲਾ ਤਾਂ ਨਹੀਂ ਕਿਹਾ ਜਾਂਦਾ ਪਰੰਤੂ ਉਹਨਾਂ ਵੱਲੋਂ ਘਰ ਦਾ ਬਣਿਆ ਹੋਇਆ ਖਾਣਾ ਹੀ ਖਾਧਾ ਜਾਂਦਾ ਹੈ ਜਦੋਂ ਕਿ ਕੋਈ ਵੀ ਮਦਦ ਨਹੀਂ ਕਰਵਾਈ ਜਾਂਦੀ ਬੜਾ ਹੀ ਦੱਕੀਆ ਨੂਸ ਟੱਬਰ ਹੈ ਕੁੜੀ ਗਿਆਰ੍ਹਾਂ ਸਾਢੇ ਗਿਆਰ੍ਹਾਂ ਕੰਮ ਖਤਮ ਕਰਕੇ ਸੌਂਦੀ ਹੈ ਅਤੇ ਸਵੇਰੇ ਚਾਰ ਵਜੇ ਉਸਨੂੰ ਉੱਠਣ ਦੇ ਹੁਕਮ ਜਾਰੀ ਹਨ ਸੱਸ ਵੀ ਅਜੇ ਤੱਕ ਪੂਰਾ ਕੰਮ ਕਰਦੀ ਹੈ ਦੇਖ ਕੇ ਤਾਂ ਬੜੀ ਹੈਰਾਨੀ ਹੁੰਦੀ ਹੈ ਚਲੋ ਕੁਝ ਨਹੀਂ ਆਪਾਂ ਤਾਂ ਇਸ ਨੂੰ ਇੱਕ ਫਿਲਮ ਵਾਂਗ ਵੇਖਾਂਗੇ ਅਤੇ ਐਕਟਰਾਂ ਦੀ ਐਕਟਿੰਗ ਨੂੰ ਇੰਜੋਏ ਕਰਾਂਗੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੇਰੀ ਇਹ ਯੋਜਨਾ ਬਹੁਤ ਪਸੰਦ ਆਈ ਹੋਵੇਗੀ